ਹੈਲੋ ਹਾਂ ਬਿਜਲੀ ਵਾਲਾ ਮੁੰਡਾ ਬੋਲਦਾ ਵੀਰੇ ਹਾਂ ਮੋਟਰ ਲਿਆਉਂਦੀ ਸੀਗੀ ਪੁੱਤ ਮੋਟਰ ਠੀਕ ਕਰਾ ਲਗਵਾਉਣੀ ਸੀਗੀ ਅਸੀਂ ਪਾਣੀ ਵਾਲੀ ਮੀਟਰ ਮੋਟਰ ਖ਼ਰਾਬ ਹੋਈ ਪਈ ਹੈ ਕੰਪਨੀ ਤਾਂ ਮਤਲਬ ਕਲਸੀ ਕ ਕੰਪਨੀ ਹੈ ਵੀਰੇ ਐਂ ਤਾਂ ਮੈਨੂੰ ਪਤਾ ਨੀ ਮੁੰਡਾ ਲੈ ਕੇ ਆਇਆ ਤੇ ਵੀ ਸਾਨੂੰ ਪਾਣੀ ਕੰਨਵੋਂ ਵੀ ਬਾਹਲਾ ਔਖਾ ਹੈ ਤੇ ਪਾਣੀ ਜ਼ਰੂਰ ਉਹ ਪਸ਼ੂਆਂ ਨੂੰ ਨਾਲੇ ਤਾਂ ਨਵਾਉਣ ਕ ਕੰਨਵੋਂ ਪਾਣੀ ਪਿਲਾਉਣ ਕੰਨਵੋਂ ਵੀ ਸਾਨੂੰ ਜਲਦੀ ਮੋਟਰ ਚਾਹੀਦੀ ਹੈ ਵੀ ਲੱਗਣੀ ਹਾਂ ਹਾਂ ਤਾਰਾਂ ਨਾਲ ਸਾਰਾ ਕੁਛ ਹੈਗਾ ਵੀਰੇ ਪਲੱਗ ਥੋੜ੍ਹਾ ਜਿਹਾ ਦੂਰ ਪੈਂਦਾ ਹੈ ਮੋਟਰ ਤੋਂ ਹਾਂ ਵਾਹਲਾ ਨਹੀਂ ਗਾ ਊਂ ਨੇੜੇ ਹੀ ਆ ਇੱਥੋਂ ਤਾਂ ਵਾਵਾ ਆਪਾਂ ਮੋਟਰ ਤੋਂ ਤਾਂ ਦੂਰ ਪੈਜੂਗਾ ਊਂ ਵੀ ਚੱਲ ਨੇੜੇ ਹੀ ਹੈ ਜੇ ਇੰਨਾ ਕੋਈ ਖ਼ਾਸ ਖਰਚੇ ਵਾਲੀ ਗੱਲ ਨਹੀਂ ਗੀ ਤਾਂ ਸਾਨੂੰ ਵੀ ਜ਼ਰੂਰ ਹੀ ਵੀ ਦੱਸ ਦੇ ਵੀ ਕਿਹੜੇ ਟਾਈਮ 'ਤੇ ਆ ਸਕਦਾ ਵੀਰੇ ਕਿਹੜੇ 'ਤੇ ਨਹੀਂ ਦੇਖ ਲਾ ਵੀਰੇ ਜੇ ਅੱਜ ਆ ਜਾਂਦੇ ਫਿੱਟ ਕਰ ਜਾਂਦੇ ਤਾਂ ਵਾਹਲੀ ਵਧੀਆ ਗੱਲ ਸੀ ਅਸੀਂ ਸਾਨੂੰ ਵਾਹਲਾ ਉਹ ਹੋਇਆ ਪਿਆ ਗਾ ਫੋ ਉਹਦਾ ਪਾਣੀ ਕੰਨਵੋਂ ਮੁਸ਼ਕਿਲ ਜਿਹੀ ਹੋਈ ਪਈ ਆ ਹਾਂ ਚੱਲ ਕੋਈ ਨਹੀਂ ਵੇਖ ਲਾ ਵੀਰੇ ਠੀਕ ਆ ਫਿਰ ਓਕੇ ਹਾਂ ਹਾਂ ਹਾਂ ਵਧੀਆ ਵਧੀਆ ਵੀਰੇ ਮੋਟਰ ਦੇ ਨਾਲ ਦੀਆਂ ਹੈਗੀਆਂ ਤਾਰਾਂ ਤਾਂ ਵਧੀਆ ਹੈ ਠੀਕ ਹੈ ਵੀਰੇ ਠੀਕ ਹੈ ਓਕੇ